ਪੰਜਾਬ ਵਿੱਚ ਨਵਜੰਮੇ ਬੱਚੇ ਦੀਆਂ ਅਲੱਗ ਅਲੱਗ ਰਸਮਾਂ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਗੁੜ੍ਹਤੀ ਗੁੜ੍ਹਤੀ ਉਸ ਬੰਦੇ ਤੋਂ ਦਵਾਈ ਜਾਂਦੀ ਹੈ ਜਿਸ 'ਤੇ ਉਸ ਉਸਦੇ ਮਾਂ ਬਾਪ ਚਾਹੁੰਦੇ ਹਨ ਕਿ ਸਾਡਾ ਬੱਚਾ ਇਸ ਤਰ੍ਹਾਂ ਦਾ ਬਣੇ ਵੱਡਾ ਹੋ ਕੇ ਅਤੇ ਬੱਚੇ ਦਾ ਨਾਮ ਰੱਖਣ ਲਈ ਗੁਰਦੁਆਰਾ ਸਾਹਿਬ ਵਿੱਚ ਹੁਕਮਨਾਮਾ ਲਿੱਤਾ ਜਾਂਦਾ ਹੈ ਅਤੇ ਜਿਹੜਾ ਪਹਿਲਾ ਸ਼ਬਦ ਹੁੰਦਾ ਹੈ ਉਸ ਤੋਂ ਬੱਚੇ ਦਾ ਨਾਮ ਰੱਖਿਆ ਜਾਂਦਾ ਹੈ ਅਤੇ ਕਈ ਲੋਕ ਆਪਣੇ ਘਰਾਂ ਵਿੱਚ ਕੇਕ ਕੱਟਦੇ ਹਨ ਬੱਚੇ ਦੀ ਹੋਣ ਦੀ ਖੁਸ਼ੀ ਦੇ ਵਿੱਚ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਦੇ ਹਨ ਅਤੇ ਸਾਰੇ ਇਸ ਗੱਲ ਦੀ ਬਹੁਤ ਖੁਸ਼ੀ ਮਨਾਉਂਦੇ ਹਨ